ਉਪਕਰਨਾਂ ਦੀ ਸਮੱਸਿਆ ਨੂੰ ਇਸ ਤਰ੍ਹਾਂ ਹੱਲ ਕਰ ਰਿਹਾ ਹੈ ਨਵੀਆਂ ਮਸ਼ੀਨਾਂ ਮੰਗਵਾ ਕੇ ਨਵੇਂ ਉਪਕਰਨਾਂ ਦੀ ਇਨਵੈਂਸ਼ਨ ਕਰਕੇ ਨਵੇਂ ਉਪਕਰਨਾਂ ਦੀ ਇਨਵੈਂਸ਼ਨ ਕਰਦੇ ਉਹਨਾਂ ਦੇ ਢਾਂਚਿਆਂ ਨੂੰ ਸੁਧਾਰ ਕੇ ਇਸ ਤਰ੍ਹਾਂ ਉਹ ਇਸ ਸਮੱਸਿਆ ਨੂੰ ਹੱਲ ਕਰ ਰਿਹਾ ਹੈ ਤਾਂ ਜੋ ਜੋ ਰਾਜ ਸਿਹਤ ਸੰਭਾਲ ਖੇਤਰ ਖੇਤਰ ਵੱਧ ਤੋਂ ਵੱਧ ਵਿਕਸਿਤ ਹੋ ਸਕੇ